ਮੈਨੂੰ ਡਾਂਸ ਕਰਨ ਦਾ ਬਹੁਤ ਹੀ ਸ਼ੋਂਕ ਹੈ ਮੈਂ ਡਾਂਸ ਸਿੱਖਿਆ ਹੋਇਆ ਹੈ ਡਾਂਸ ਅਕੈਡਮੀ ਤੋਂ ਜਿੱਥੋਂ ਕਿ ਮੇਰੇ ਉਸ ਉਸਤਾਦ ਜੀ ਨੇ ਮੈਨੂੰ ਬਹੁਤ ਹੀ ਅੱਛੀ ਤਰ੍ਹਾਂ ਡਾਂਸ ਸਿਖਾਇਆ ਹੋਇਆ ਹੈ ਮੈਂ ਕਿਸੇ ਵੀ ਆਪਣੇ ਫੈਮਿਲੀ ਫੰਕਸ਼ਨ 'ਚ ਜਾਂ ਕਿਸੇ ਵੀ ਯਾਰ ਦੋਸਤ ਦੀ ਪਾਰਟੀ 'ਚ ਡਾਂਸ ਕਰਦਾ ਹਾਂ ਅਤੇ ਸਾਰੇ ਲੋਕ ਮੇਰਾ ਡਾਂਸ ਦੇਖ ਕੇ ਮੈਨੂੰ ਐਪਰੀਸ਼ੇਟ ਐਪਰੀਸ਼ੇਟ ਕਰਦੇ ਹਨ ਕਿ ਬਹੁਤ ਵਧੀਆ ਡਾਂਸ ਹੈ ਮੇਰੇ ਮੇਰੇ ਮੈਨੂੰ ਮੈਨੂੰ ਆਪਣੇ ਡਾਂਸ ਕਰਨ ਕਰਨ 'ਤੇ ਇੰਨਾ ਕੁ ਵਧੀਆ ਲੱਗਦਾ ਹੈ ਮੈਂ ਇੰਨਾ ਕੁ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਕਰਦਾ ਹਾਂ ਜਦੋਂ ਮੈਂ ਡਾਂਸ ਕਰਦਾ ਹਾਂ ਅਤੇ ਮੈਂ ਕਈ ਵਾਰ ਆਪਣੇ ਸਕੂਲ ਫੰਕਸ਼ਨ 'ਚ ਜਾਂ ਆਪਣੇ ਕੋਲਜ ਫੰਕਸ਼ਨ 'ਚ ਮੈਂ ਬਹੁਤ ਡਾਂਸ ਕੀਤਾ ਹੋਇਆ ਹੈ ਮੇਰੀਆਂ ਵੀਡੀਓ ਵੀ ਬਹੁਤ ਹੀ ਲੀਕ ਹੋਈਆਂ ਸੀ ਵਾਇਰਲ ਹੋਈਆਂ ਸੀ ਕਿ ਮਤਲਬ ਜਿੱਦਾਂ ਕਿ ਆਪਣੇ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਡਾਂਸ ਪ੍ਰੋਫੈਸ਼ਨ ਨੂੰ ਵੱਧ ਤੋਂ ਵੱਧ ਰਿਪ੍ਰੇਜੈਂਟ ਕਰਾਂ ਕਿ ਮੇਰਾ ਡਾਂਸ ਦੇ ਤੌਰ 'ਤੇ ਮੈਂ ਕੋਂਪੀਟੀਸ਼ਨ ਲੜ੍ਹਾਂ ਜਿਵੇਂ ਕਿ ਆਪਣੇ ਮੈਂ ਆਪਣੇ ਡਿਸਟਿਕ ਲੈਵਲ ਤੱਕ ਮੈਂ ਗਿਆ ਹੋਇਆ ਇਹਦੇ ਇਹਦੇ ਨਾਲ ਕਿ ਮੇਰੀ ਇੱਕ ਅਲੱਗ ਪਹਿਚਾਣ ਬਣੇ ਅਤੇ ਮੇਰੇ ਪਰਿਵਾਰ ਦਾ ਨਾਂ ਵਧੀਆ ਹੋਵੇ ਅਤੇ ਮੈਂ ਆਪਣੇ ਪੰਜਾਬ ਦੇ ਨਾਂ ਪੰਜਾਬ ਪੰਜਾਬ ਨੂੰ ਅੱਗੇ ਤੋਂ ਅੱਗੇ ਲੈ ਕੇ ਜਾਵਾਂ ਅਤੇ ਮੈਂ ਆਪਣਾ ਪੰਜਾਬ ਪੰਜਾਬ ਮੈਂ ਚਾਹੁੰਦਾ ਹਾਂ ਕਿ ਮੈਂ ਨੈਸ਼ਨਲ ਨੈਸ਼ਨਲ ਤੱਕ ਵੀ ਜਾਵਾਂ ਮਤਲਬ ਕਿ ਆਪਣਾ ਇਨਕਮ ਓਫ ਸੋਰਸ ਮੇਰਾ ਵਧੀਆ ਹੋਵੇ ਅਤੇ ਮੇਰੀ ਪਹਿਚਾਣ ਕੁਛ ਵਧੀਆ ਬਣੇ